ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਅਸੀਂ ਕਾਫੀ ਅਭਿਆਸਾਂ ਦੀ ਪਾਲਣਾ ਕਰਦੇ ਹਾਂ ਜਿਵੇਂ ਕਿ ਆਪਾਂ ਜੇਕਰ ਘਰੇਲੂ ਇਲਾਜ ਦੀ ਗੱਲ ਕਰੀਏ ਪਾਣੀ ਨੂੰ ਉਬਾਲ ਦੇਣਾ ਮਤਲਬ ਜਿਵੇਂ ਪਾਣੀ ਨੂੰ ਕਿਸੇ ਭਾਂਡੇ ਵਿੱਚ ਪਾਉਣਾ ਅਤੇ ਉਹਨੂੰ ਉਬਾਲ ਦੇਣਾ ਪੂਰਾ ਚੰਗੀ ਤਰ੍ਹਾਂ ਰਿੰਨ ਦੇਣਾ ਜਦੋਂ ਤੱਕ ਉਹ ਪਾਣੀ ਰਿੰਨੇਗਾ ਤਦ ਤੱਕ ਮਤਲਬ ਪੂਰਾ ਉਹਨੂੰ ਰਿਨ ਦੇ ਜਾਣਾ ਜਦੋਂ ਪੂਰਾ ਰਿੰਨ ਜਾਵੇਗਾ ਫਿਰ ਗੈਸ ਨੂੰ ਬੰਦ ਕਰ ਦੇਣਾ ਫਿਰ ਜਦੋਂ ਤੱਕ ਉਹ ਠੰਡਾ ਹੈਗਾ ਜਦੋਂ ਤੱਕ ਉਹ 'ਚ ਸਾਰੇ ਕੀਟਾਣੂ ਮਰ ਜਾਣਗੇ ਅਤੇ ਪਾਣੀ ਪੂਰਾ ਪਿਓਰ ਹੋ ਜਾਵੇਗਾ ਇੱਕ ਦੂਜਾ ਤਰੀਕਾ ਇਸ ਤਰ੍ਹਾਂ ਆ ਕਿ ਮੈਂ ਪੜ੍ਹਿਆ ਸੀਗਾ ਕਿ ਫਿਟਕਰੀ ਦੇ ਨਾਲ ਵੀ ਪਾਣੀ ਨੂੰ ਸਾਫ਼ ਕੀਤਾ ਜਾ ਸਕਦਾ ਹੈ ਜਿਵੇਂ ਆਪਾਂ ਕੋਈ ਵੀ ਭਾਂਡਾ ਲਿਆ ਉਹਦੇ 'ਚ ਆਪਾਂ ਪਾਣੀ ਰੱਖਿਆ ਹੈ ਕੋਈ ਵੀ ਮਤਲਬ ਪਾਣੀ ਰੱਖਿਆ ਹੈ ਅਤੇ ਉਹਦੇ ਵਿੱਚ ਆਪਾਂ ਫਟਕਰੀ ਜੇਕਰ ਪਾ ਕੇ ਥੋੜ੍ਹੀ ਦੇਰ ਛੱਡ ਦੇਈਏ ਅਤੇ ਥੋੜ੍ਹੇ ਦੇਰ ਬਾਅਦ ਜੇਕਰ ਆਪਾਂ ਵੇਖੀਏ ਤਾਂ ਪਾਣੀ ਇੱਕਦਮ ਸਾਫ਼ ਹੋ ਜਾਂਦਾ ਠੀਕ ਹੈ ਨਾ ਅਤੇ ਜਾਂ ਆਪਾਂ ਆਪਣਾ ਪਾਣੀ ਨੂੰ ਪੁਣ ਲਈਏ ਕੋਟਨ ਦੇ ਕੱਪੜੇ ਨਾਲ ਤਾਂ ਵੀ ਪਾਣੀ ਸਾਫ਼ ਹੋ ਜਾਂਦਾ ਆ ਠੀਕ ਹੈ ਇੱਕ ਹੋਰ ਨੁਸਖਾ ਆ ਮੈਂ ਪੜ੍ਹਿਆ ਸੀਗਾ ਕਿ ਜਿਵੇਂ ਕੋਈ ਵੀ ਗੰਦਾ ਪਾਣੀ ਇਕੱਠਾ ਹੋਇਆ ਵਾ ਉੱਥੋਂ ਆਪਾਂ ਇੱਕ ਮੋਟਰ ਲਾ ਕੇ ਇੱਕ ਕੰਟੇਨਰ ਵੇ ਇਹ ਕੰਟੇਨਰ ਲਵਾਂਗੇ ਕੰਟੇਨਰ ਵਿੱਚ ਪਹਿਲਾਂ ਥੱਲੇ ਕਨਕਰੀਟ ਪੱਥਰ ਰੱਖਾਂਗੇ ਫਿਰ ਉਹਦੇ ਉੱਪਰ ਥੋੜ੍ਹੀ ਮਿੱਟੀ ਪਾਵਾਂਗੇ ਅਤੇ ਜਦੋਂ ਆਪਾਂ ਤਲਾਬ 'ਚੋਂ ਉਹ ਪਾਣੀ ਮੋਟਰ ਦੇ ਰਾਹੀਂ ਕੰਟੇਨਰ ਵਿੱਚ ਪਾਵਾਂਗੇ ਪਾਣੀ ਕੰਟੇਨਰ ਦੇ ਵਿੱਚੋਂ ਪਾਸ ਆਊਟ ਹੋਏਗਾ ਤਾਂ ਉਹ ਕੀ ਕਰ ਦਵੇਗਾ ਪੂਰੇ ਪਾਣੀ ਨੂੰ ਸਾਫ਼ ਕਰਦੇ ਹੋਏ ਚੱਲ ਜਾਵੇਗਾ ਅਤੇ ਉਹ ਪਾਣੀ ਅੱਗੇ ਜਾ ਕੇ ਕਿਸੇ ਹੋਰ ਸਾਫ਼ ਕੰਟੇਨਰ ਵਿੱਚ ਸਟੋਰ ਹੋ ਜਾਵੇਗਾ ਅਤੇ ਇਹ ਸਾਨੂੰ ਕੁਝ ਘਰੇਲੂ ਨੁਸਖੇ ਜਿਹਦੇ ਵਿੱਚ ਆਪਾਂ ਪਾਣੀ ਨੂੰ ਬਿਲਕੁਲ ਸਾਫ਼ ਕਰ ਸਕਦੇ ਹਾਂ